ਪੰਜਾਬ ਦੇ ਵਿੱਚ ਲੋਕ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਮਨਾਉਣ ਦੇ ਲਈ ਜਿਵੇਂ ਹੀਰ ਰਾਂਝਾ ਗਾਂਦੇ ਨੇ ਅਤੇ ਹੀਰਾਂ ਜੀ ਦੇ ਕਿੱਸੇ ਸੁਣਾਏ ਜਾਂਦੇ ਨੇ ਜਿਵੇਂ ਮਿਊਜ਼ਿਕ ਦੇ ਵਿੱਚ ਸੰਗੀਤ ਸੁਣਦੇ ਨੇ ਪੁਰਾਣਾ ਸੰਗੀਤ ਲੋਕ ਗੀਤ ਸੁਣਾਏ ਜਾਂਦੇ ਨੇ ਵਿਆਹ ਹੋਏ ਉੱਥੇ ਘੋੜੀਆਂ ਮੁੰਡੇ ਦਾ ਵਿਆਹ ਹੋਏ ਤਾਂ ਘੋੜੀਆਂ ਗਾਈਆਂ ਜਾਂਦੀਆਂ ਨੇ ਕੁੜੀ ਦਾ ਵਿਆਹ ਹੋਵੇ ਸੁਹਾਗ ਗਾਏ ਜਾਂਦੇ ਨੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਨਾਨਕੇ ਦਾਦਕਿਆਂ ਦਾ ਮੇਲ ਨੂੰ ਇੱਕ ਦੂਜੇ ਨੂੰ ਸਿੱਠਣੀਆਂ ਦਿੰਦੇ ਨੇ ਅਤੇ ਜਿਵੇਂ ਪੁਰਾਣੀ ਸੱਸੇ ਸੱਸੀ ਪੁੰਨੂ ਦੇ ਕਿੱਸੇ ਸੁਣਾਉਂਦੇ ਨੇ ਬਹਿ ਕੇ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਅਤੇ ਆਪਣੇ ਸੱਭਿਆਚਾਰ ਦੇ ਨਾਲ ਰਿਲੇਟਿਡ ਜਿਹੜਾ ਪਹਿਰਾਵਾ ਹੈ ਉਹ ਪਾਉਂਦੇ ਨੇ ਧੀਆਂ ਦਾ ਤਿਉਹਾਰ ਮਨਾਇਆ ਜਾਂਦਾ ਉਹਦੇ ਵਿੱਚ ਵੀ ਲੋਕ ਵਿਰਾਸਤੀ ਜਿਹੜੇ ਨੇ ਲੋਕ ਨਾਚ ਕਰਦੇ ਨੇ ਲੋ ਜਿਹੜੇ ਸਾਡੇ ਗਿੱਧਾ ਭੰਗੜਾ ਇਹ ਪਾਏ ਜਾਂਦੇ ਨੇ ਬੋਲੀਆਂ ਪਾਉਂਦੀਆਂ ਨੇ ਕੁੜੀਆਂ ਇਸ ਤਰੀਕੇ ਦੇ ਨਾਲ ਜਿਹੜੇ ਆਪਣੀ ਵਿਰਾਸਤ ਹੈ ਉਹਨੂੰ ਕਾਇਮ ਰੱਖਦੇ ਨੇ ਉਹਨੂੰ ਮਨਾਉਂਦੇ ਹਨ